ਮੋਹਾਲੀ ਜ਼ਿਲ੍ਹੇ ਵਿੱਚ ਮੋਸਟਲੀ ਜੋ ਹੈ ਤੀਆਂ ਦਾ ਜ਼ਿਆਦਾ ਫੇਮਸ ਹੈ ਤੀਆਂ ਜ਼ਿਆਦਾ ਮਨਾਈਆਂ ਜਾਂਦੀਆਂ ਤੀਆਂ ਜੋ ਜਿਸ ਚੀਜ਼ ਲਈ ਫੇਮਸ ਹੈ ਪ੍ਰਸਿੱਧ ਹੈ ਉਹ ਹੈ ਕਿ ਲੜਕੀਆਂ ਵਿਆਹੀਆਂ ਹੋਈਆਂ ਲੜਕੀਆਂ ਆਪਣੇ ਪੇਕੇ ਆਉਂਦੀਆਂ ਅਤੇ ਸਾਰੀਆਂ ਇਕੱਠੀਆਂ ਹੋ ਕੇ ਉਸ ਚੀਜ਼ ਨੂੰ ਮਨਾਉਂਦੀਆਂ ਖੁਸ਼ੀ ਮਨਾਉਂਦੀਆਂ ਪੇਕੇ ਆਉਣ ਦਾ ਇੱਕ ਰੀਜ਼ਨ ਹੁੰਦਾ ਕਾਰਨ ਹੁੰਦਾ ਕਿ ਅਸੀਂ ਉੱਥੇ ਆ ਕੇ ਖੁਸ਼ੀਆਂ ਮਨਾਉਂਦੀਆਂ ਝੂਲੇ ਪੀਘਾਂ ਝੂਟਦੀਆਂ ਕਾਫੀ ਕੁਛ ਖਾਣ ਦਾ ਬਣਾਇਆ ਹੁੰਦਾ ਸਿਸਟਮ ਕਿ ਇੱਕ ਜਗ੍ਹਾ ਖਾਣ ਲਈ ਲੱਗੇ ਹੁੰਦੇ ਨੇ ਸਟੋਲਸ ਅਲੱਗ ਅਲੱਗ ਤਰੀਕੇ ਨਾਲ ਸਾਰੇ ਮਤਲਬ ਪੂਰੇ ਮੋਹਾਲੀ 'ਚ ਇੱਕੋ ਤਰ੍ਹਾਂ ਨਹੀਂ ਮਨਾਉਂਦੇ ਸਾਰੇ ਅਲੱਗ ਅਲੱਗ ਤਰੀਕੇ ਨਾਲ ਮਨਾਉਂਦੇ ਆ ਕੋਈ ਪੀਘਾਂ ਝੂਟਦੀਆਂ ਕੋਈ ਚਰਖੇ ਕੱਤਦੀਆਂ ਅਲੱਗ ਅਲੱਗ ਤਰੀਕੇ ਹੁੰਦੇ ਆ ਮਤਲਬ ਮਨਾਉਣ ਨਾਲ ਇਸ ਨਾਲ ਇੱਕ ਸੱਭਿਆਚਾਰਕ ਅਤੇ ਭਾਈਚਾਰਕ ਦੋਨੋਂ ਚੀਜ਼ਾਂ ਹੋ ਜਾਂਦੀਆਂ ਮਤਲਬ ਮਿਲਣਸਾਰ ਹੋ ਜਾਂਦਾ ਕਿ ਸਾਰੇ ਇਕੱਠੇ ਬੈਠ ਕੇ ਆਪਣੇ ਦੁੱਖ ਸੁੱਖ ਕਰਦੇ ਆ ਖੁਸ਼ੀਆਂ ਮਨਾਉਂਦੇ ਆ